ਪੰਜਾਬ ਵਿੱਚ ਮਨੋਰੰਜਨ ਦੇ ਰਿਵਾਈਤੀ ਢੰਗ ਲ ਭੰਗੜਾ ਅਤੇ ਗਿੱਧਾ ਹੈ ਭੰਗੜਾ ਪੰਜਾਬੀ ਲੋਕ ਨਾਚ ਗਿੱਧਾ ਲੋਕ ਨ੍ਰਿੱਤ ਦਾ ਰੂਪ ਜੋ ਉਤਸ਼ਾਹ ਅਤੇ ਊਰਜਾ ਨਾਲ ਕੀਤਾ ਜਾਂਦਾ ਹੈ ਇਹ ਨਾਚ ਦੀ ਸਭ ਦੋ ਸ਼ਾਨਦਾਰ ਰੂਪਾਂ ਵਿੱਚੋਂ ਇੱਕ ਹੈ ਜੋ ਕਿਸੇ ਦੀ ਆਜ਼ਾਦੀ ਨੂੰ ਪੂਰੀ ਤਰ੍ਹਾਂ ਵੱਖਰੇ ਪੱਧਰ 'ਤੇ ਉਭਾਰਦਾ ਹੈ ਭੰਗੜਾ ਭੰਗੜੇ ਦੀ ਸ਼ੁਰੂਆਤ ਪੰਜ ਦਰਿਆਵਾਂ ਦੀ ਧਰਤੀ ਤੋਂ ਹੋਈ ਹੈ ਜਿਸ ਨੂੰ ਆਮ ਤੌਰ 'ਤੇ ਪੰਜਾਬ ਦੇ ਨਾਲ ਜਾਣਿਆ ਜਾਂਦਾ ਹੈ ਪੰਜਾਬ ਦੇ ਵਿੱਚ ਭੰਗੜਾ ਹਰ ਖੇਤਰ ਵਿੱਚ ਮਨਾਇਆ ਕੀਤਾ ਜਾਂਦਾ ਹੈ ਭੰਗੜੇ ਦੀ ਸ਼ੁਰੂਆਤ ਪੰਜ ਸੌ ਸਾਲ ਤੱਕ ਕੀਤੀ ਜਾ ਸਕਦੀ ਹੈ ਹਾਲਾਂਕਿ ਇਹ ਬਹੁਤ ਪਹਿਲਾ ਤੋਂ ਮੌਜੂਦ ਹੋ ਸਕਦੀ ਸੀ ਭੰਗੜਾ ਦੀਆਂ ਬੁਨਿਆਦੀ ਅੰਦੋਲਨਾਂ ਖੇਤੀਬਾੜੀ ਦੀਆਂ ਗਤੀਵਿਧੀਆਂ ਨਾਲ ਸੰਬੰਧਿਤ ਹੁੰਦੀਆਂ ਹਨ ਭੰਗੜਾ ਸੀਜਨ ਵਿਸਾਖੀ ਨਾਲ ਸ਼ੁਰੂ ਹੁੰਦਾ ਹੈ ਇਹ ਇੱਕ ਤਿਉਹਾਰ ਜੋ ਕਿ ਪਿਛਲੇ ਸੀਜਨ ਦੀ ਕਾਮਯਾਬੀ ਲਈ ਕਿਸਾਨਾਂ ਦੀ ਖੁਸ਼ੀ ਦੇ ਮੁੱਢ ਨੂੰ ਦਰਸਾਉਂਦਾ ਹੈ ਅਤੇ ਜੀ ਨਵੇਂ ਸੀਜਨ ਦੇ ਆਗਮਨ ਲਈ ਵੀ ਹਰ ਸਾਲ ਚੌਦਾਂ ਅਪ੍ਰੈਲ ਨੂੰ ਸੂਰਜੀ ਨਾਲ ਦੀ ਸ਼ੁਰੂਆਤ ਨੂੰ ਦਰਸਾਉਂਦਾ ਹੈ ਇਸ ਲਈ ਇਹ ਪੰਜਾਬੀਆਂ ਅਤੇ ਹੋਰ ਸਾਰੇ ਭਾਈਚਾਰਿਆਂ ਵਿੱਚ ਨਵਾਂ ਸਾਲ ਵੀ ਮਨਾਇਆ ਜਾਂਦਾ ਹੈ ਭੰਗੜੇ ਦਾ ਸੰਗੀਤ ਬਹੁਤ ਹੀ ਜੀਵੰਤ ਹੈ ਅਤੇ ਇਸ ਦਾ ਸਰੋਤਿਆਂ 'ਤੇ ਮਾੜਾ ਅਸਰ ਪਿਆ ਹੈ ਸੰਗੀਤ ਦੀ ਪਾਲਣਾ ਦੇ ਖੁੱਲ੍ਹੇ ਦਿਲ ਅਤੇ ਅਨਿਸ਼ਚਿਤ ਬਹਾਰ ਨੂੰ ਬਾਹਰ ਕੱਢਿਆ ਗਿਆ ਹੈ ਜੋ ਲੋਕਾਂ ਨੂੰ ਸ਼ਕਤੀਸ਼ਾਲੀ ਤਰੀਕੇ ਨਾਲ ਲਾਉਣ ਦੀ ਇਜਾਜਤ ਦਿੰਦੇ ਹਨ ਇਹ ਆਮ ਤੌਰ 'ਤੇ ਇੱਕ ਸਿੰਗਲ ਤਾਰਿਆ ਸਾਧਨ ਇਸ ਨੂੰ ਟੂਬੀ ਅਤੇ ਚਿਤਮਾਂ ਕਹਿੰਦੇ ਹਨ ਅਤੇ ਨਾਲ ਹੀ ਢੋਲ ਦੀ ਹਰਾਇਆ ਜਾਂਦਾ ਹੈ ਕਿਸੇ ਵੀ ਕਾਰਗੁਜ਼ਾਰੀ ਵਿੱਚ ਕੋਸ਼ ਕਸ਼ੋਮ ਇੱਕ ਮਹੱਤਵਪੂਰਨ ਹਿੱਸਾ ਹੈ ਅਤੇ ਭੰਗੜਾ ਵਿਚ ਇਸ ਨੂੰ ਜ਼ਿਆਦਾ ਹੈ ਕਿਉਂਕਿ ਇਹ ਊਰਜਾ ਨੂੰ ਅਜਿਹੇ ਵਸਤੂਆਂ ਦੇ ਭੜਕੀਲੇ ਰੰਗਾਂ ਤੋਂ ਬਦਲਦਾ ਹੈ ਜੋ ਆਮ ਤੌਰ 'ਤੇ ਡਾਂਸਰ ਦੁਆਰਾ ਵਰਤੇ ਜਾਂਦੇ ਹਨ